ਕਰੋਨਾ ਮਹਾਮਾਰੀ ਦੇ ਆਉਣ ਦੇ ਕਾਰੋਬਾਰਾਂ ਵਿੱਚ ਕਾਫੀ ਫੇਰ ਬਦਲ ਵੇਖਣ ਨੂੰ ਮਿਲਿਆ ਇਸ ਦੌਰਾਨ ਕਾਰੋਬਾਰੀਆਂ ਦੇ ਬਹੁਤ ਸੇ ਹਾਨੀਆਂ ਵੀ ਹੋਈਆਂ ਅਤੇ ਕੁਝ ਨਵੇਂ ਕਾਰੋਬਾਰ ਵੀ ਨਿਕਲ ਕੇ ਆਏ ਕਰੋਨਾ ਮਹਾਮਾਰੀ ਦੇ ਆਉਣ ਦੇ ਨਾਲ ਕਾਰੋਬਾਰੀਆਂ ਦੇ ਇਕਦਮ ਕੰਮ ਠੱਪ ਪੈ ਗਏ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਕਿੱਦਾਂ ਸਮਾਨ ਨੂੰ ਖਾ ਉਸਦੇ ਗਾ ਗ੍ਰਾਹਕ ਤੱਕ ਪਹੁੰਚਾਇਆ ਜਾਏ ਜ਼ਿੰਦਗੀ ਬਹੁਤ ਮੁਸ਼ਕਿਲ ਹੋਣ ਲੱਗ ਪਈ ਸੀ ਹਰ ਤਰ੍ਹਾਂ ਦਾ ਲੋਕ ਪੈਸੇ ਦੀ ਤੰਗੀ ਮਹਿਸੂਸ ਕਰਨ ਲੱਗ ਪਏ ਸੀ ਕਾਰੋਬਾਰੀਆਂ ਕੋਲ ਸਮਾਨ ਆਉਣਾ ਬੰਦ ਹੋ ਗਿਆ ਸੀ ਜਦੋਂ ਉਹਨਾਂ ਕੋਲ ਸਮਾਨ ਨਹੀਂ ਪਹੁੰਚੇਗਾ ਤਾਂ ਅੱਗੇ ਕਿੱਦਾਂ ਜਾਏਗਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀਗਾ ਹੋਟਲਾਂ ਵਾਲਿਆ ਦਾ ਹੋਟਲਾਂ ਵਿੱਚ ਲੋਕਾਂ ਨੇ ਜਾਣਾ ਛੱਡ ਦਿੱਤਾ ਸ਼ਾਮਾਂ ਬਿਲਕੁਲ ਸੁੰਨਸਾਨ ਹੋ ਗਈਆਂ ਖਾਣ ਪੀਣ ਦੀ ਕੋਈ ਇੱਛਾ ਕਿਸੇ ਨੇ ਜਿਤਾਉਣੀ ਛੱਡਤੀ ਸੀ ਲੋਕਾਂ ਨੇ ਆਪਣੇ ਘਰਾਂ ਵਿੱਚ ਬਣਾਉਣਾ ਸਿੱਖ ਲਿਆ ਸੀ ਇਹ ਸਭ ਤੋਂ ਵਧੀਆ ਚੀਜ਼ ਸੀ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਆਪਣੀ ਸਿਹਤ ਦਾ ਧਿਆਨ ਰੱਖਣ ਲੱਗ ਪਿਆ ਸੀ ਚੰਗਾ ਖਾਣਾ ਪੀਣਾ ਵਾਪਸ ਸ਼ੁਰੂ ਹੋ ਗਿਆ ਸੀ ਸੋਸ਼ਲ ਮੀਡੀਆ ਦੀ ਮਦਦ ਦੇ ਨਾਲ ਆਪਸ 'ਚ ਲੋਕ ਜੁੜੇ ਹੋਏ ਸੀ ਅਤੇ ਬਹੁਤ ਕੁਛ ਜ਼ਿੰਦਗੀ ਦੇ ਵਿੱਚ ਅਲੱਗ ਹੀ ਵੇਖਣ ਨੂੰ ਮਿਲਿਆ ਕਿ ਅਸੀਂ ਆਪਣੇ ਸਮੇਂ 'ਚ ਆਪਣੇ ਘਰ ਨੂੰ ਜਿਸ ਨੂੰ ਅਸੀਂ ਬਹੁਤ ਪਿਆਰ ਦੇ ਨਾਲ ਬਣਾਇਆ ਹੈ ਉਸ ਵਿੱਚ ਚੌਵੀ ਘੰਟੇ ਕੁਛ ਮਹੀਨਿਆਂ ਦਾ ਅਸੀਂ ਖੁਦ ਆਪਣੇ ਘਰ ਨੂੰ ਹੀ ਆਪਣੇ ਪਿਆਰ ਨਾਲ ਆਪਣੇ ਘਰ ਨੂੰ ਹੀ ਆਪਣੇ ਕੰਮ ਵੀ ਬਣਾ ਦਿੱਤਾ ਸੀ ਅਤੇ ਆਪਣੇ ਘਰ ਦੇ ਵਿੱਚ ਹੀ ਜੀਣਾ ਸਿੱਖਿਆ ਸੀ